ਪੰਜਾਬ ਵਿੱਚ ਖੇਡ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਕੋਚਾਂ ਦੇ ਪੱਧਰ 'ਤੇ ਖਿਡਾਰੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਚੰਗੇ ਖਿਡਾਰੀਆਂ ਜਿਹੜੇ ਵਧੀਆ ਖੇਡਣ ਵਾਲੇ ਖਿਡਾਰੀ ਹੁੰਦੇ ਹਨ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ ਅਤੇ ਸਿਫਾਰਸ਼ੀ ਜੋ ਪਲੇਅਰ ਹੁੰਦੇ ਨੇ ਕਿਸੇ ਲੀਡਰ ਦਾ ਬੱਚਾ ਕਿਸੇ ਪੋਲੀਟੀਸ਼ੀਅਨ ਦਾ ਕਿਸੇ ਐਮ ਸੀ ਦਾ ਕਿਸੇ ਜਾਣ ਪਛਾਣ ਵਾਲੇ ਦਾ ਬੱਚਾ ਹੈ ਉਹਨਾਂ ਨੂੰ ਮਤਲਬ ਐਡ ਕਰ ਲਿਆ ਜਾਂਦਾ ਹੈ ਟੀਮ ਦੇ ਵਿਚ ਅਤੇ ਐਡ ਕਰਨ ਤੋਂ ਬਾਅਦ ਟੀਮ ਦੇ ਵਿੱਚ ਉਹਨਾਂ ਨੂੰ ਉੱਪਰ ਤੱਕ ਖਿਡਾਇਆ ਜਾਂਦਾ ਹੈ ਖਿਡਾਇਆ ਵੀ ਸ਼ਿਫਾਰਿਸ਼ਾਂ 'ਤੇ ਜਾਂਦਾ ਹੈ ਕਈ ਟੀਮਾਂ ਨਾਲ ਵੀ ਵਿਤਕਰੇਬਾਜ਼ੀ ਹੁੰਦੀ ਹੈ ਚੰਗੀ ਟੀਮ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈਗਾ ਕੋਈ ਨਾ ਕੋਈ ਇਤਰਾਜ਼ ਲਗਾ ਕੇ ਜੇ ਮਾੜੀ ਟੀਮ ਹੁੰਦੀ ਹੈ ਉਸਨੂੰ ਅੱਗੇ ਲੈ ਜਾਂਦੇ ਹਨ ਅੱਗੇ ਲਿਜਾ ਕੇ ਉਸ ਟੀਮ ਨੂੰ ਵਿਜੇਤਾ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਇਹਨਾਂ ਨੂੰ ਹੱਲ ਸਰਕਾਰੀ ਸਰਕਾਰ ਦੇ ਪੱਧਰ 'ਤੇ ਕੀਤਾ ਜਾ ਸਕਦਾ ਹੈ ਜੇਕਰ ਰਾਜਨੀਤਿਕ ਲੋਕ ਨੇ ਜੋ ਉਹ ਆਪਦੀ ਦਖਲਅੰਦਾਜ਼ੀ ਬੰਦ ਕਰ ਦੇਣ ਅਤੇ ਕੋਚ ਨੇ ਜੋ ਉਹ ਕਿਸੇ ਦਾ ਦਬਾਉ ਹੇਠਾਂ ਆ ਕੇ ਖਿਡਾਰੀਆਂ ਦੇ ਨਸਲਕੁਸ਼ੀ ਕਰਨੀ ਬੰਦ ਕਰ ਦੇਣ ਜਿੰਨਾ ਟਾਈਮ ਪੰਜਾਬ ਦੇ ਵਿੱਚ ਰਾਜਨੀਤਿਕ ਲੋਕਾਂ ਦਾ ਬੋਲਬਾਲਾ ਰਹੇਗਾ ਖੇਡਾਂ ਦੇ ਵਿੱਚ ਉੱਨਾਂ ਟਾਈਮ ਇਹਨਾਂ ਚੀਜ਼ਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ